ਭਾਰਤੀ ਸਮਾਜ ਵਿੱਚ ਧਰਮ ਦੀ ਜੋ ਭੂਮਿਕਾ ਹੈ ਉਹ ਸਾਰੇ ਭਾਰਤ ਵਿੱਚ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਧਰਮਾਂ ਕਬੀਲਿਆਂ ਦੇ ਲੋਕ ਜੋ ਵੀ ਇੱਕ ਦੂਜੇ ਨਾਲ਼ ਰਲ਼ ਮਿਲਕੇ ਰਹਿੰਦੇ ਹਨ ਅਤੇ ਆਪਣੇ ਆਪਣੇ ਧਰਮ ਦੇ ਵਿੱਚ ਰਹਿਣ ਕਰਕੇ ਵੀ ਦੂਸਰੇ ਦੇ ਧਰਮ ਪ੍ਰਤੀ ਉਹ ਸਭ ਵਫ਼ਾਦਾਰੀ ਨਿਭਾਉਂਦੇ ਹਨ ਕਿਸੇ ਦੂਜੇ ਧਰਮ ਨੂੰ ਚੰਗਾ ਹੀ ਕਹਿਣਾ ਉਹਨਾਂ ਦੀ ਫਿਤਰਤ ਹੁੰਦੀ ਹੈ ਮਾੜਾ ਸੋਚਣਾ ਕਿਸੇ ਦੂਜੇ ਦੇ ਧਰਮ ਬਾਰੇ ਚੰਗੀ ਗੱਲ ਨਹੀਂ ਹੈ ਭਾਰਤੀ ਸਮਾਜ ਵਿੱਚ ਇਹ ਹੀ ਸਭ ਤੋਂ ਵੱਡੀ ਅਨੇਕਤਾਂ ਵਿੱਚ ਏਕਤਾ ਕਿਉਂਕਿ ਵੱਖ ਵੱਖ ਧਰਮਾਂ ਦੇ ਲੋਕ ਜਿਹੜੇ ਵੀ ਇੱਥੇ ਰਹਿ ਰਹੇ ਹਨ ਬੜੇ ਰਲ਼ ਮਿਲ ਕੇ ਆਪਣੇ ਪਿਆਰ ਮੁਹੱਬਤ ਨਾਲ਼ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਵੀ ਕਰਦੇ ਹਨ ਜਿਸ ਤਰ੍ਹਾਂ ਕਿ ਬੋਰਡਰਾਂ 'ਤੇ ਜੋ ਮਿਲਟਰੀ ਵਾਲੇ ਭਰਾ ਸਾਡੇ ਫੌਜੀ ਵੀਰ ਰਹਿੰਦੇ ਹਨ ਸਾਰੇ ਬੋਡਰਾਂ 'ਤੇ ਵੱਖੋ ਵੱਖ ਜਾਤੀਆਂ ਕਿਸਮਾਂ ਦੇ ਹੋਣ ਕਰਕੇ ਵੀ ਉਹਨਾਂ ਦਾ ਆਪਸ ਵਿੱਚ ਖਾਣਾ ਪੀਣਾ ਹੱਸਣਾ ਨੱਚਣਾ ਗਾਉਣਾ ਸਭ ਤਰ੍ਹਾਂ ਦੇ ਤਿਉਹਾਰ ਇੱਕ ਦੂਜੇ ਦੇ ਧਰਮਾਂ ਦੇ ਮਨਾਉਣੇ ਉਹਨਾਂ ਸਭ ਦੀ ਇਹ ਬੜੀ ਵਿਸ਼ੇਸ਼ਤਾ ਹੈ ਅਤੇ ਧਰਮ ਦੇ ਵਿੱਚ ਇਨਸਾਨੀਅਤ ਹੀ ਸਭ ਤੋਂ ਵੱਡੀ ਭੂਮਿਕਾ ਨਿਭਾਉਣਾ ਨਜ਼ਰ ਆਉਂਦਾ ਹੈ ਤਾਂ ਕਿ ਸਾਰੇ ਲੋਕ ਆਪਣੇ ਭਾਈਚਾਰਿਕ ਸਾਂਝ ਬਣਾਈ ਰੱਖਣ ਇੱਕ ਕਿ ਆਪਣੇ ਆਪਣੇ ਧਰਮਾਂ ਦੀ ਵਿੱਚ ਰਹਿ ਕੇ ਵੀ ਦੂਸਰੇ ਧਰਮਾਂ ਦਾ ਸਤਿਕਾਰ ਕਰਨ ਦੇ ਲਈ ਤਤਪਰ ਰਹਿੰਦੇ ਹਨ